ਅਸੀਂ ਆਪਣੇ ਜੀਵਨ ਵਿੱਚ ਟਰੇਡ ਮਿਲ ਬਾਰੇ ਅਲੱਗ ਅਲੱਗ ਸੋਚਦੇ ਹਾਂ ਟਰੇਡ ਮਿਲ 'ਤੇ ਕੰਮ ਕਰਨਾ ਅਤੇ ਜ਼ਮੀਨ 'ਤੇ ਦੌੜਨਾ ਅਲੱਗ ਅਲੱਗ ਪਹਿਲੂ ਹਨ ਟਰੇਡ ਮਿਲ ਅਤੇ ਜ਼ਮੀਨ 'ਤੇ ਦੌੜਨਾ ਦੋਹਾਂ ਦਾ ਹੀ ਬਿਆਨ ਦੇ ਤਰੀਕੇ ਅਲੱਗ ਅਲੱਗ ਪਾਏ ਗਏ ਹਨ ਉਹਨਾਂ ਵਿੱਚ ਕੁਝ ਅੰਤਰ ਹੁੰਦਾ ਹੈ ਮੈਂ ਤੁਹਾਨੂੰ ਆਪਣੇ ਜੀਵਨ ਅਨੁਸਾਰ ਟਰੇਡ ਮਿਲ ਦੀਆਂ ਸੁਵਿਧਾਵਾਂ ਬਾਰੇ ਦੱਸਦਾ ਹਾਂ ਟਰੇਡ ਮਿਲ ਕੀ ਹੈ ਟਰੇਡ ਮਿਲ ਉੱਤੇ ਦੌੜਨਾ ਆਮ ਤੌਰ 'ਤੇ ਘਰ ਜਾਂ ਜਿੰਮ ਵਿੱਚ ਹੀ ਕਰ ਦਿੱਤਾ ਜਾਂਦਾ ਹੈ ਜੋ ਮੌਸਮ ਅਤੇ ਬਾਹਰੀ ਹਾਲਾਤਾਂ ਦੇ ਅਨੁਸਾਰ ਆਜ਼ਾਦ ਹੁੰਦਾ ਹੈ ਇਸ ਨਾਲ ਦੌੜਨ ਦੀ ਰੋਜ਼ਾਨਾ ਲਗਾਤਾਰਤਾ ਵੀ ਬਰਕਰਾਰ ਰੱਖਣ ਵਿੱਚ ਸਹਾਇਤਾ ਮਿਲਦੀ ਹੈ ਸਰਫੇਸ ਦੇ ਟਰੇਡੀ ਟਰੇਡ ਮਿਲ 'ਤੇ ਦੌੜਦੇ ਸਮੇਂ ਸਹੀ ਤਰੀਕੇ 'ਤੇ ਸੈੱਟ ਕੀਤੀ ਗਈ ਝੂਲਣ ਵਾਲੀ ਪਟੜੀ ਹੋਣ ਕਾਰਨ ਮੌਸਮ ਅਤੇ ਥੱਲੇ ਦੀ ਜ਼ਮੀਨ ਦੀ ਅਸਮਾਨਤਾ ਤੋਂ ਵੀ ਬਹੁਤ ਬਚਾਅ ਹੁੰਦਾ ਹੈ ਜ਼ਮੀਨ 'ਤੇ ਦੌੜਨ ਸਮੇਂ ਜ਼ਮੀਨ ਦੀ ਅਸਮਾਨਤਾ ਕੰਕਰੀਟ ਅਤੇ ਹੋਰ ਸਖਤ ਸਤਹਿਆਂ ਅਤੇ ਸਹੀ ਦੌੜਨ ਦੀ ਪੁਜੀਸ਼ਨ ਸਿਹਤ 'ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਾ ਸਕਦੇ ਹਨ ਪ੍ਰਕਾਸ਼ ਅਤੇ ਹਵਾ ਦੁਆਰਾ ਟਰੇਡ ਮਿਲ 'ਤੇ ਦੌੜਨ ਦੌਰਾਨ ਆਮ ਤੌਰ 'ਤੇ ਘਰ ਦੇ ਅੰਦਰ ਹੋਣ ਕਾਰਨ ਵਾਤਾਵਰਨ ਜ਼ਿਆਦਾ ਨਹੀਂ ਬਦਲਿਆ ਜ਼ਮੀਨ 'ਤੇ ਦੌੜਨ ਦੇ ਨਾਲ ਨਾਲ ਸਾਡੇ ਹਵਾ ਅਤੇ ਤਬਦੀਲ ਹੁੰਦੇ ਵਾਤਾਵਰਨ ਦੀ ਸਮੱਸਿਆ ਹੁੰਦੀ ਹੈ ਜੋਇੰਟਸ 'ਤੇ ਵੀ ਬਹੁਤ ਜ਼ਿਆਦਾ ਅਸਰ ਪਾਇਆ ਜਾਂਦਾ ਹੈ ਟਰੇਡ ਮਿਲ 'ਤੇ ਦੌੜਨ ਦੇ ਨਾਲ ਜ਼ਮੀਨ ਦੀ ਤਰ੍ਹਾ ਸਖਤ ਸਤਹਿ ਦੀ ਸਮੱਸਿਆ ਜ਼ਿਆਦਾ ਨਹੀਂ ਹੁੰਦੀ ਇਸ ਨਾਲ ਜੁਆਇੰਟਸ ਦੇ ਆਉਣ ਵਾਲਾ ਬਦਲਾਓ ਦਬਾਓ ਵੀ ਜ਼ਿਆਦਾ ਨਹੀਂ ਹੁੰਦਾ ਜਿਸ ਨਾਲ ਜੁਆਇੰਟਸ 'ਤੇ ਥੋੜ੍ਹਾ ਘੱਟ ਅਸਰ ਹੁੰਦਾ ਹੈ ਇਸ ਦੇ ਨਾਲ ਨਾਲ ਜੁਆਇੰਟਸ ਦੀਆਂ ਪੇਸ਼ੀਆਂ 'ਤੇ ਥੋੜ੍ਹਾ ਘੱਟ ਅਸਰ ਵੀ ਪੈਂਦਾ ਹੈ ਟਰੇਡ ਮਿਲ ਦੇ ਦੌੜਨ ਨਾਲ ਜ਼ਮੀਨ ਦੀ ਹਰ ਤਰ੍ਹਾਂ ਦੀ ਸਤਹਿ ਦੀ ਸਮੱਸਿਆ ਦਾ ਵੀ ਕੋਈ ਜ਼ਿਆਦਾ ਅਲੱਗ ਨਹੀਂ ਹੁੰਦਾ ਪੇਸ਼ੀ ਵਿਕਾਸ ਬਹੁਤ ਜ਼ਿਆਦਾ ਜ਼ਮੀਨ 'ਤੇ ਦੌੜਨ ਸਮੇਂ ਅਲੱਗ ਅਲੱਗ ਚੁਣੌਤੀਆਂ ਅਤੇ ਹਾਲਾਤਾਂ ਦੇ ਨਾਲ ਨਾਲ ਪੇਸ਼ੀਆਂ ਨੂੰ ਵਧੇਰੇ ਤਣਾਓ ਮਿਲਦਾ ਹੈ ਟਰੇਡ ਮਿਲ 'ਤੇ ਜਦੋਂ ਚੁਣੌਤੀਆਂ ਕਾਬੂ ਵਿੱਚ ਹੁੰਦੀਆਂ ਹਨ ਤਾਂ ਪੇਸ਼ੀਆਂ ਨੂੰ ਵਧੇਰੇ ਚੁਣੌਤੀ ਨਹੀਂ ਮਿਲਦੀ ਦੋਹਾਂ ਦੀਆਂ ਆਪਣੀਆਂ ਅਲੱਗ ਅਲੱਗ ਟੀਚੇ ਸਹੂਲਤਾਂ ਹਨ ਟਰੇਡਮਿਲ ਬਾਰੇ ਦੌੜਨ ਨਾਲ ਜ਼ਮੀਨ ਦੀ ਤਰ੍ਹਾਂ ਜ਼ਿਆਦਾ ਸਖਤ ਦੀ ਸਤਹਿ ਦੀ ਸਮੱਸਿਆ ਨਹੀਂ ਹੁੰਦੀ ਪੇਸ਼ੀ ਵਿਕਾਸ ਟਰੇਡਿੰਗ ਨਾਲ ਬਹੁਤ ਜ਼ਿਆਦਾ ਹੁੰਦਾ ਹੈ ਇਸ ਨੂੰ ਪੇਸ਼ੀਆਂ ਨੂੰ ਵਧੇਰੇ ਚੁਣੌਤੀ ਦਾ ਵੀ ਨਹੀਂ ਸਾਹਮਣਾ ਕਰਨਾ ਪੈਂਦਾ ਧੰਨਵਾਦ